ਮੈਂ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਕੋਲਜ ਵਿੱਚ ਕੰਮ ਕਰਦਾ ਹਾਂ ਮੇਰਾ ਉਰੇ ਮੈਡੀਕਲ ਕਾਰਡ ਬਣਿਆ ਹੈ ਜਿਵੇਂ ਈ ਐੱਸ ਆਈ ਕਾਰਡ ਕਹਿ ਦਿੰਦੇ ਹੈ ਇਹਨਾਂ ਪਰ ਦਵਾਈਆਂ ਮੁਫਤ ਮਿਲਦੀਆਂ ਹਨ ਜਿਵੇਂ ਕੋਈ ਵੀ ਇਲਾਜ ਘਰ ਦਾ ਮੈਂਬਰ ਢਿੱਲਾ ਹੋ ਜਾਵੇ ਉਹਨਾਂ ਨੂੰ ਚੰਗੀ ਤਰ੍ਹਾਂ ਦੇਖਭਾਲ ਕਰਦੇ ਆਂ ਜੀ ਦਵਾਈਆਂ ਬਹੁਤ ਵਧੀਆ ਦਿੰਦੇ ਆ ਜੀ ਬਹੁਤ ਵਧੀਆ ਆਰਾਮ ਕਰਦੀਆਂ ਦਵਾਈਆਂ ਜੀ ਮੇਰੇ ਸਾਰੇ ਪਰਿਵਾਰ ਦਾ ਜੀ ਕਾਰਡ 'ਚ ਨਾਂ ਪਾਇਆ ਵਾ ਜਿਨ੍ਹਾਂ ਨੇ ਜਿਹੜਾ ਪੰਜ ਲੱਖ ਵਾਲਾ ਜੀ ਆਪਣਾ ਕਾਰਡ ਹੁੰਦਾ ਉਹ ਵੀ ਬਹੁਤ ਵਧੀਆ ਸਕੀਮ ਆ ਸਰਕਾਰ ਨੇ ਬਹੁਤ ਵਧੀਆ ਉਹਦੇ ਨਾਲ ਕਰਿਆ ਹਰੇਕ ਹੌਸਪੀਟਲ ਦੇ ਵਿੱਚ ਚਲਦਾ ਜੀ ਕਾਰਡ ਇਹਨਾਂ ਦਾ ਜਿਹੜਾ ਈ ਐੱਸ ਆਈ ਕਾਰਡ ਹੈ ਜੀ ਇਹ ਕੋਲਜ ਵੱਲੋਂ ਆ ਜੀ ਜਿਵੇਂ ਮੇਰੇ ਡੈਡੀ ਜੀ ਪਿੱਛੇ ਜਿਹੇ ਢਿੱਲੇ ਹੋ ਗਏ ਤੇ ਜੀ ਉਹਨਾਂ ਨੂੰ ਨਾ ਮੈਂ ਹੌਸਪੀਟਲ ਲੈ ਗਿਆ ਜੀ ਚਲੋ ਮੇਰਾ ਖਰਚਾ ਤਾਂ ਪਰ ਹੋਇਆ ਮਾੜਾ ਜਿਹਾ ਘੱਟ ਹੋਇਆ ਨੋਰਮਲ ਹੈ ਜੀ ਪਰ ਇਹਨੇ ਇਹ ਕਾਰਡ ਨਾਲ ਜੀ ਮੈਨੂੰ ਵਧੀਆ ਬਹੁਤ ਵਧੀਆ ਲੱਗਿਆ ਜੀ ਕਾਰਡ ਬਹੁਤ ਮਤਲਬ ਵੀ ਵਧੀਆ ਇਹਨਾਂ ਨੇ ਇੱਕ ਸਰਕਾਰ ਨੇ ਕਰਿਆ ਵਾ ਜੀ ਸਹੂਲਤਾਂ ਦਿੱਤੀਆਂ ਵੀ ਸਾਨੂੰ ਜੀ ਅਤੇ ਇਹਨਾਂ ਨੇ ਪੈਸਾ ਨਹੀਂ ਲੱਗਣ ਦਿੱਤਾ ਜੀ ਅਤੇ ਦੇਖਭਾਲ ਬਹੁਤ ਵਧੀਆ ਕਰੀ ਹੈ ਮੇਰੇ ਡੈਡੀ ਦੀ ਜੀ ਅਤੇ ਦਵਾਈਆਂ ਦਵੂਈਆਂ ਵੀ ਵਧੀਆ ਦਿੰਦੇ ਹੈ ਜੀ ਅਤੇ ਡਾਕਟਰ ਬੇਚਾਰੇ ਬਹੁਤ ਪੁੱਛਦੇ ਆ ਜੀ ਅਤੇ ਰੋਟੀ ਪਾਣੀ ਦਾ ਵੀ ਉਹਨਾਂ ਦਾ ਹੌਸਪੀਟਲ 'ਚ ਹੈ ਜੀ ਸਾਰਾ ਕੁਛ ਰੋਟੀ ਪਾਣੀ ਵੀ ਕੋਲ ਵਧੀਆ ਦਿੰਦੇ ਆ ਅਤੇ ਜਿਹੜਾ ਨਾਲ ਪੇਸੈਟ ਦੇ ਨਾਲ ਜਾਂਦਾ ਬੰਦਾ ਘਰ ਦਾ ਮੈਂਬਰ ਉਹਨਾਂ ਨੂੰ ਵੀ ਰੋਟੀ ਪਾਣੀ ਵਧੀਆ ਤਰੀਕੇ ਨਾਲ ਦਿੰਦੇ ਆ ਜੀ ਸਾਫ਼ ਸੁਥਰਾ ਕੰਮ ਆ ਜੀ ਅਤੇ ਜਿਹੜਾ ਆਪਣਾ ਦੇਖਭਾਲ ਕਰਦੇ ਆ ਐਨ ਚੰਗੀ ਤਰ੍ਹਾਂ ਕਰਦੇ ਆ ਜੀ ਦੇਖ ਭਾਲ ਜਿਵੇਂ ਇਹਨਾਂ ਨੇ ਹੈਲਪਰ ਰੱਖੇ ਵੇ ਜੀ ਉੱਥੇ ਗਾ ਉਹ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਜੀ ਵੀ ਸਾਨੂੰ ਆਪਣੇ ਆਪ ਨੂੰ ਵੀ ਨਹੀਂ ਜ਼ਰੂਰਤ ਪੈਂਦੀ ਵੀ ਚੱਲ ਆਪਣੇ ਮਾਤਾ ਪਿਤਾ ਨੂੰ ਫੜ ਲਈਏ ਉਹ ਆਪ ਕੇਅਰ ਕਰਦੇ ਆ ਸਾਰੀ ਜੀ